ਸਾਡੇ ਖੇਤਰਾਂ ਦੇ ਵਿੱਚ ਆਮ ਤੌਰ 'ਤੇ ਮੌਤ ਦਰ ਦੀ ਜੋ ਬਾ ਪਾ ਮੌਤ ਦਰ ਹੈ ਜੋ ਉਹ ਬਾਲ ਬੱਚਿਆਂ ਦੀ ਥਾਂ 'ਤੇ ਨੌਜਵਾਨ ਬੱਚਿਆਂ ਦੀ ਦਰ ਕਾਫੀ ਜ਼ਿਆਦਾ ਹੈ ਬਾਲ ਬੱਚਿਆਂ ਦੇ ਵਾਸਤੇ ਤਾਂ ਸਾਨੂੰ ਸਰਕਾਰ ਕਾਫੀ ਸਕੀਮਾਂ ਦੇ ਰਹੀ ਹੈ ਟੀਕਾਕਰਨ ਉਪਲਬਧ ਕਰਾ ਰਹੀ ਹੈ ਖਾਣਾ ਉਪਲਬਧ ਕਰਾ ਰਹੀ ਹੈ ਕਮਜ਼ੋਰ ਬੱਚਿਆਂ ਲਈ ਅਲੱਗ ਖਾਣਾ ਭੇਜ ਰਹੀ ਆ ਬਾਲ ਦਰ ਮੌਤ ਨਹੀਂ ਹੈ ਸਾਡੇ ਪਿੰਡਾਂ ਦੇ ਖੇਤਰਾਂ ਦੇ ਵਿੱਚ ਆਮ ਤੌਰ 'ਤੇ ਸਾਡੇ ਖੇਤਰਾਂ ਦੇ ਵਿੱਚ ਹੈ ਨੌਜਵਾਨ ਮੌਤ ਦਰ ਸਭ ਤੋਂ ਜ਼ਿਆਦਾ ਹੈ ਉਹ ਹੈ ਪੰਦਰਾਂ ਸੋਲ੍ਹਾਂ ਸਤਾਰਾਂ ਅਠਾਰਾਂ ਉੱਨੀ ਵੀਹ ਇੱਕੀ ਸਾਲ ਦੇ ਬੱਚਿਆਂ ਦੀ ਜੋ ਮੌਤ ਦਰ ਵਧ ਰਹੀ ਹੈ ਇਹ ਵਧ ਰਹੀ ਹੈ ਨਸ਼ੇ ਦੇ ਕਾਰਨ ਸਾਡੇ ਖੇਤਰਾਂ ਦੇ ਵਿੱਚ ਚਿੱਟੇ ਦਾ ਨਸ਼ਾ ਕਾਫੀ ਜ਼ਿਆਦਾ ਫੈਲ ਚੁੱਕਿਆ ਹੈ ਜਿਸ ਕਰਕੇ ਸਾਡੇ ਨੌਜਵਾਨ ਬੱਚੇ ਖਤਮ ਹੋ ਰਹੇ ਹਨ ਇਸ ਬਾਰੇ ਸਰਕਾਰ ਸਾਡੇ ਬੱਚਿਆਂ ਲਈ ਕੁਛ ਨਾ ਕੁਛ ਜ਼ਰੂਰ ਕਰੇ ਇਸ ਪਾਸੇ ਵੱਲ ਧਿਆਨ ਦੇਵੇ ਤਾਂ ਕਿ ਸਾਡੇ ਨੌਜਵਾਨ ਬੱਚੇ ਬਚਾਏ ਜਾ ਸਕਣ ਬਾਲ ਦਰ ਸਾਡੇ ਖੇਤਰਾਂ ਵਿੱਚ ਨਹੀਂ ਹੈ ਬਾਲ ਦਰਾਂ ਵਾਸਤੇ ਬਾਲ ਬੱਚਿਆਂ ਵਾਸਤੇ ਕਾਫੀ ਕੁਛ ਕਰ ਰਹੀ ਹੈ ਸਰਕਾਰ ਉਹ ਦਰ ਅੱਜ ਦੇ ਟਾਈਮ ਵਿੱਚ ਖਤਮ ਹੋ ਚੁਕੀ ਹੈ ਨੌਜਵਾਨ ਮੌਤ ਦਰ ਵਧ ਚੁਕੀ ਹੈ ਉਹਦੇ ਲਈ ਹੀ ਅਸੀਂ ਸਰਕਾਰ ਦੇ ਮੂਹਰੇ ਅਪੀਲ ਕਰਦੇ ਹਾਂ ਕਿ ਪਲੀਜ਼ ਇਸ ਚਿੱਟੇ ਦੇ ਨਸ਼ੇ ਨੂੰ ਖਤਮ ਕੀਤਾ ਜਾ ਸਕੇ ਤਾਂ ਕਿ ਸਾਡੀ ਨੌਜਵਾਨ ਬੱਚੇ ਬਚ ਸਕਣ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਰਹੇ ਹਨ ਨਸ਼ੇ ਦੇ ਕਾਰਨ ਸਾਡੇ ਪੈਸੇ ਦੀ ਬਰਬਾਦੀ ਹੋ ਰਹੀ ਹੈ ਸਾਡੇ ਘਰਾਂ ਦੇ ਘਰ ਖਾਲੀ ਹੋ ਚੁੱਕੇ ਹਨ ਸਾਡੀਆਂ ਜ਼ਮੀਨਾਂ ਖਤਮ ਹੋ ਚੁੱਕੀਆਂ ਹਨ ਸਾਡੇ ਬੱਚੇ ਸਾਡੇ ਤੋਂ ਬਾਹਰ ਹੋ ਚੁੱਕੇ ਹਨ ਇਸ ਲਈ ਸਾਡੇ ਖੇਤਰ ਦੇ ਵਿੱਚ ਬਾਲ ਦਰ ਦੀ ਥਾਂ 'ਤੇ ਨੌਜਵਾਨ ਮੌਤ ਦਰ ਕਾਫੀ ਵਧ ਚੁਕੀ ਹੈ